ਮੈਨੂੰ ਬਗੀਚੇ ਦਾ ਸ਼ੌਕ ਬਾਗਬਾ ਬਾਗਬਾਨੀ ਦਾ ਸ਼ੌਕ ਬਚਪਨ ਤੋਂ ਹੀ ਹੈ ਕਿਉਂਕਿ ਖੇਤੀਬਾੜੀ ਸਾਡਾ ਘਰੇਲੂ ਜਿਹੜੀ ਮੇਰੇ ਮਾਤਾ ਪਿਤਾ ਦਾ ਕ ਕਾਰੋਬਾਰ ਖੇਤੀਬਾੜੀ ਸੀ ਅਤੇ ਮੈਂ ਜਿਹੜੀ ਪੜ੍ਹਾਈ ਕੀਤੀ ਪੰਜਵੀਂ ਤੋਂ ਬਾਅਦ ਛੇਵੀਂ ਦੇ ਵਿੱਚ ਖੇਤੀਬਾੜੀ ਦਾ ਵਿਸ਼ਾ ਵੀ ਚੋਣਵੇਂ ਵਿਸ਼ਿਆਂ ਵਿੱਚ ਚੁਣਿਆ ਘਰੇਲੂ ਬਗੀਚਾ ਇੱਕ ਬਹੁਤ ਲਾਹੇਵੰਦ ਚੀਜ਼ ਹੈ ਇਹਦੇ ਵਿੱਚ ਅਸੀਂ ਬਿਨਾਂ ਸਪਰੇਅ ਤੋਂ ਬਿਨਾਂ ਕਿਸੇ ਕੀੜੇਮਾਰ ਦਵਾਈ ਦੀ ਵਰਤੋਂ ਕਰੇ ਘਰ ਸਬਜ਼ੀਆਂ ਤਿਆਰ ਕਰ ਸਕਦੇ ਹੈ ਇਹਦੇ ਜਿਹੜੀ ਘਰੇਲੂ ਖਾਦ ਵੀ ਵ ਮੁੱਲ ਲੈਣ ਦੀ ਕੋਈ ਲੋੜ ਨਹੀਂ ਘਰੇਲੂ ਸਾਡੇ ਘਰ ਗੋਹੇ ਵਾਲੀ ਖਾਦ ਜਾਂ ਗੰਡੋਏ ਵਾਲੀ ਖਾਦ ਵਰਤੀ ਜਾਂਦੀ ਹੈ ਘਰੇ ਬਗੀਚੀ ਦੇ ਇੰਨੇ ਫਾਇਦੇ ਨੇ ਕਿ ਜਿਸ ਤਰ੍ਹਾਂ ਮਹਿੰਗਾਈ ਹੈ ਸਬਜ਼ੀਆਂ ਬਹੁਤ ਮਹਿੰਗੀਆਂ ਹਨ ਘਰ ਅਸੀਂ ਲੋੜ ਮੁਤਾਬਿਕ ਛੋਟੀ ਕਿਆਰੀ ਹਰ ਇੱਕ ਨੂੰ ਘਰ ਬਗੀਚਾ ਲਾਉਣਾ ਚਾਹੀਦਾ ਅਤੇ ਉਹਦੇ 'ਚ ਮੌਸਮੀ ਸਬਜ਼ੀਆਂ ਬੀਜਣੀਆਂ ਚਾਹੀਦੀਆਂ ਨੇ ਜਿਹੜੀਆਂ ਕਿ ਬਹੁਤ ਜ਼ਿਆਦਾ ਘੱਟ ਖਰਚੇ 'ਤੇ ਤਿਆਰ ਹੋ ਜਾਂਦੀਆਂ ਹਨ ਅਤੇ ਇਹਨਾਂ ਦੇ ਕੋਈ ਵੀ ਬਿਮਾਰੀ ਇਹਨਾਂ ਨੂੰ ਇੰਨੀ ਖਾਸ ਨਹੀਂ ਲੱਗਦੀ ਅਤੇ ਜਿਹੜੇ ਖਾਣ ਨਾਲ ਵੀ ਸਾਡਾ ਜਿਹੜਾ ਸਰੀਰ ਆ ਉਹ ਤੰਦਰੁਸਤ ਰਹਿੰਦਾ ਕਿਉਂਕਿ ਇਹ 'ਤੇ ਕੋਈ ਸਪਰੇਅ ਜਾਂ ਕੋਈ ਖਾਦ ਦੀ ਵਰਤੋਂ ਨਹੀਂ ਹੋਈ ਹੁੰਦੀ ਬਗੀਚੀ ਦਾ ਜਿਹੜਾ ਘੱਟੋ ਘੱਟ ਹਰ ਇੱਕ ਨੂੰ ਹਰੇਕ ਘਰ ਵਾਲੇ ਨੂੰ ਇੱਕ ਬਗੀਚੀ ਜ਼ਰੂਰ ਲਾਉਣੀ ਚਾਹੀਦੀ ਹੈ